ਭਾਰਤੀ ਕਲਾ ਸ਼ੈਲੀਆਂ ਬਹੁਤ ਸਾਰੀਆਂ ਹਨ ਜਿਹੜੀਆਂ ਅੱਜ ਦੇ ਯੁੱਗ ਦੇ ਵਿੱਚ ਅਲੋਪ ਹੁੰਦੀਆਂ ਜਾ ਰਹੀਆਂ ਹਨ ਅਤੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਸੰਭਾਲਣ ਦੀ ਲੋੜ ਹੈ ਇਸ ਦੇ ਵਿੱਚ ਹ ਹੱਥੀਂ ਕਲਾ ਸ਼ੈਲੀਆਂ ਜ਼ਿਆਦਾ ਹਨ ਜਿਵੇਂ ਕਿ ਹੱਥੀਂ ਬੁਣਨਾ ਹੱਥੀਂ ਕੱਢਣਾ ਜਿਵੇਂ ਕਿ ਪਿਛਲੇ ਸਮਿਆਂ ਦੇ ਵਿੱਚ ਚਰਖੇ 'ਤੇ ਕੱਤ ਕੇ ਰੂੰ ਬਣਾਈ ਜਾਂਦੀ ਸੀ ਅਤੇ ਹੱਥੀਂ ਕੰਮ ਕੀਤੇ ਜਾਂਦੇ ਸਨ ਅਤੇ ਘੁਮਿਆਰ ਮਿੱਟੀ ਦੇ ਬਰਤਨ ਬਣਾਉਂਦਾ ਸੀ ਇਹ ਸਾਰੇ ਹੱਥੀਂ ਸ਼ਿਲਪਕਾਰੀਆਂ ਵਿੱਚ ਆਉਂਦੇ ਹਨ